ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਸੁਣਾਓ ਹਾਂਜੀ ਹਾਂਜੀ ਦੱਸੋ ਕਿਹੜੀ ਇਹ ਸਾਰੀਆਂ ਹਾਲੇ ਗੋਲਡ ਦਾ ਲੱਖ ਹੈ ਔਰ ਸਿਲਵਰ ਦਾ ਅੱਸੀ ਹਜ਼ਾਰ ਹੈ ਅਤੇ ਡਾਇਮੰਡ ਦਾ ਡੇਢ ਲੱਖ ਤੱਕ ਆਰਟੀਫਿਸ਼ਅਲ ਵੀ ਪੰਜਾਹ ਹਜ਼ਾਰ ਤੱਕ ਹਾਂਜੀ ਸਾਰੇ ਕਲਰ ਦੇ ਹੈਗੇ ਹਾਂਜੀ ਹਾਂਜੀ ਹਾਂਜੀ ਆਪਾਂ ਤੁਹਾਨੂੰ ਸੈਂਪਲ ਵਟਸਐਪ 'ਤੇ ਭੇਜ ਦਿਆਂਗੇ ਤੁਸੀਂ ਦੇਖ ਲਿਓ ਕਿ ਜਿਹੜਾ ਤੁਹਾਨੂੰ ਸਹੀ ਲੱਗੇ ਹਾਂ ਲੈਸ ਵੀ ਹੋ ਜਾਏਗਾ ਤੁਸੀਂ ਦੁਕਾਨ 'ਤੇ ਆਓਗੇ ਇੱਕ ਵਾਰ ਵੇਖੋਗੇ ਕਿੱਦਾਂ ਦੇ ਲੱਗੇ ਤਾਂ ਥੋੜ੍ਹਾ ਬਹੁਤਾ ਲੈਸ ਵੀ ਹੋ ਜਾਵੇਗਾ ਹਾਂ ਦਸ ਪ੍ਰਸੈਂਟ ਡਿਸਕਾਊਂਟ 'ਤੇ ਹੋ ਜਾਵੇਗਾ

ਹਾਂਜੀ ਨਹੀਂ ਪਰ ਜਵੈਲਰੀ ਦਸ ਪ੍ਰਸੈਂਟ ਡਿਸਕਾਊਂਟ 'ਤੇ ਮਿਲੇਗੀ ਚਲੋ ਠੀਕ ਆ ਪੰਦਰਾਂ ਹਾਂ ਪੰਦਰਾਂ ਪ੍ਰਸੈਂਟ ਹਾਂ ਮੈਂ ਮੈਂ ਕਰ ਦੇਵਾਂਗੀ ਵਟਸਐਪ 'ਤੇ ਸੈਂਡ ਤੁਹਾਨੂੰ ਹਾਂਜੀ ਠੀਕ ਹੈ